ਡੇਂਗੂ ਬੁਖਾਰ ਅਤੇ ਮਲੇਰੀਆ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ ਜਿਨ੍ਹਾਂ ਦੀ ਕਿ ਕੁਝ ਅਭਿਆਸਾਂ ਦੀ ਪਾਲਣਾ ਕਰਨ ਨਾਲ਼ ਇਹਨਾਂ ਤੋਂ ਬਚਿਆ ਜਾ ਸਕਦਾ ਹੈ ਜਿਵੇਂ ਕਿ ਕਿਸੇ ਵੀ ਜਗ੍ਹਾ 'ਤੇ ਪਾਣੀ ਨਾ ਇਕੱਠਾ ਹੋਣ ਦਿਉ ਅਗਰ ਕਿਤੇ ਪਾਣੀ ਇਕੱਠਾ ਵੀ ਹੈ ਤਾਂ ਉਸ ਕਰਨਾ ਵੀ ਹੈ ਤਾਂ ਉਸਨੂੰ ਹਫ਼ਤੇ ਦੇ ਅੰਦਰ ਅੰਦਰ ਜ਼ਰੂਰ ਬਦਲ ਦਿਉ ਆਪਣੇ ਪਰਦੇ ਖਿੜਕੀਆਂ ਰੋਜ਼ ਸੁਬਹਾ ਜ਼ਰੂਰ ਖੋਲ੍ਹੋ ਘਰ ਵਿੱਚ ਰੌਸ਼ਨੀ ਆਉਣ ਦਿਉ ਹਰ ਐਤਵਾਰ ਤੁਹਾਡੇ ਘਰ ਕਿਤੇ ਵੀ ਸਾਫ਼ ਸਫ਼ਾਈ ਕਰੋ ਅਗਰ ਕਿਤੇ ਕੋਈ ਪਾਣੀ ਜਾਂ ਕੂੜਾ ਕਰਕਟ ਹੈ ਤਾਂ ਉਸਦੀ ਸਫ਼ਾਈ ਕਰੋ